ਵੈਸੇ ਮੈਨੂੰ ਔਨਲਾਈਨ ਸ਼ੋਪਿੰਗ ਨਾ ਜ਼ਿਆਦਾ ਪਸੰਦ ਨਹੀਂ ਹੈਗੀ ਬਟ ਮੈਨੂੰ ਕੁਛ ਅਰਜੈਂਸੀ ਸੀਗੀ ਤਾਂ ਮੇਰੀ ਬੇਟੀ ਦੇ ਪੇਪਰ ਚੱਲ ਰਹੇ ਸੀਗੇ ਫਿਰ ਮੈਨੂੰ ਇਹ ਸੀ ਵੀ ਮੈਂ ਔਨਲਾਈਨ ਹੀ ਔਡਰ ਕਰਦਾ ਹੁਣ ਮੈਂ ਸ਼ੋਪਿੰਗ ਲਈ ਜਾ ਨਹੀਂ ਪਾਉਂਗੀ ਠੰਡ ਦਾ ਇੱਕ ਫੰਕਸ਼ਨ ਸੀਗਾ ਅਤੇ ਫਿਰ ਮੈਂ ਕੀ ਕੀਤਾ ਇੱਕ ਜੈਕਟ ਮੈਂ ਔਨਲਾਈਨ ਏ ਔਡਰ ਕੀਤੀ ਆਪਣੇ ਲਈ ਬੜੀ ਮੈਂ ਐਕਸਾਈਟਡ ਸੀਗੀ ਕਿਉਂਕਿ ਪਹਿਲਾਂ ਵੀ ਮੈਂ ਇੱਕ ਵਾਰੀ ਔਡਰ ਕੀਤੀ ਸੀ ਅਤੇ ਬਹੁਤ ਵਧੀਆ ਚੀਜ਼ ਆਈ ਸੀਗੀ ਮੇਰੀ ਅੱਛੀ ਲੱਗੀ ਸੀ ਅਤੇ ਮੈਂ ਇਹੀ ਸੋਚ ਕੇ ਸੇਮ ਸਾਈਟ ਤੋਂ ਫਿਰ ਦੁਬਾਰਾ ਇੱਕ ਜੈਕਟ ਔਡਰ ਕਰਤੀ ਬਟ ਜਦੋਂ ਮੈਂ ਡਿਲੀਵਰ ਹੋਈ ਮੈਨੂੰ ਜੈਕਟ ਜਦੋਂ ਮੈਂ ਖੋਲ੍ਹ ਕੇ ਦੇਖੀ ਮਤਲਬ ਮੇਰਾ ਮੂੜ ਇੰਨਾ ਖਰਾਬ ਹੋਇਆ ਕਿ ਜਿੰਨੇ ਮਤਲਬ ਮੈਂ ਪੈਸੇ ਦਿੱਤੇ ਸੀਗੇ ਪੇ ਕੀਤੇ ਸੀਗੇ ਉਸ ਜੈਕਟ ਦੇ ਲਈ ਉਹਦੇ ਅਕੋਡਿੰਗ ਕੁਛ ਵੀ ਉਦਾਂ ਦਾ ਨਹੀਂ ਸੀਗਾ ਜੋ ਪਿਕਚਰ ਦੇ ਵਿੱਚ ਦਿਖਾਇਆ ਗਿਆ ਸੀਗਾ ਉਹਦੇ ਨਾਲੋਂ ਬਿਲਕੁਲ ਹੀ ਡਿਫਰੈਂਟ ਸੀਗੀ ਪਹਿਲੀ ਗੱਲ ਤਾਂ ਜਿਹੜਾ ਉਹਦਾ ਕਲਰ ਸੀਗਾ ਉਹ ਵੀ ਡਿਫਰੈਂਟ ਸੀ ਪਿਕਚਰ ਨਾਲੋਂ ਅਤੇ ਉਹਦਾ ਜਿਹੜਾ ਮਟੀਰੀਅਲ ਸੀ ਮਤਲਬ ਇੰਨਾ ਘਟੀਆ ਲਗਾਇਆ ਹੋਇਆ ਸੀਗਾ ਵੀ ਜਿੰਨੇ ਪੈਸੇ ਉਹਨਾਂ ਦੇ ਮੇਰੇ ਤੋਂ ਲਿੱਤੇ ਉਹ ਮਤਲਬ ਉਹਦੇ ਹਾਫ 'ਤੇ ਵੀ ਮੈਂ ਬੁਣਾ ਲੈਂਦੀ ਜੇ ਮੈਂ ਦੇਖ ਕੇ ਲੈਂਦੀ ਉਹ ਇਹ ਚੀਜ਼ ਨੂੰ ਅਤੇ ਇਸ ਕਰਕੇ ਜਿਹੜਾ ਮੇਰਾ ਸੈਕਿੰਡ ਐਕਸਪੀਰੀਅੰਸ ਸੀ ਇਸ ਸਾਈਟ ਤੋਂ ਬਿਲਕੁਲ ਅੱਛਾ ਨਹੀਂ ਰਿਹਾ ਹੈਗਾ ਜੈਕਟ ਦਾ